ਸਤਿ ਸ਼੍ਰੀ ਅਕਾਲ ਭਾਜੀ ਮੈਂ ਤੁਹਾਡੀ ਦੁਕਾਨ ਤੋਂ ਓਪੋ ਦਾ ਫੋਨ ਓਡਰ ਕੀਤਾ ਸੀ ਮੈਂ ਪਹਿਲੀ ਵਾਰ ਇਹ ਔਨਲਾਈਨ ਓਡਰ ਕੀਤਾ ਅਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਇਹ ਇੱਕ ਤਾਂ ਤੁਸੀਂ ਨਿਰਧਾਰਤ ਸਮੇਂ 'ਤੇ ਤੁਸੀਂ ਇਸ ਨੂੰ ਮੇਰੇ ਪਤੇ 'ਤੇ ਭੇਜ ਦਿੱਤਾ ਅਤੇ ਜਦੋਂ ਮੈਂ ਇਹ ਓਡਰ ਖੋਲ੍ਹਿਆ ਤਾਂ ਇਸ ਦੀ ਲੁੱਕ ਇਸ ਦਾ ਕਲਰ ਮੈਨੂੰ ਬਹੁਤ ਹੀ ਪਸੰਦ ਆਇਆ ਅਤੇ ਇਸ ਦਾ ਬੈਟਰੀ ਪੈਕਅਪ ਅਤੇ ਕੈਮਰਾ ਕੁਆਲਟੀ ਬਹੁਤ ਹੀ ਵਧੀਆ ਜਦੋਂ ਮੈਂ ਇਸ ਨੂੰ ਵਰਤਿਆ ਅਤੇ ਇਸ ਦੀ ਅੰਦਰ ਫੀਚਰਜ਼ ਵੀ ਬਹੁਤ ਹੀ ਵਧੀਆ ਨੇ ਅਤੇ ਇਸ ਦੀ ਹੈਗਿੰਗ ਪ੍ਰੋਬਲਮ ਵੀ ਨਹੀਂ ਹੈ ਅਤੇ ਇਹ ਪ੍ਰੋਡਕਟ ਮੇਰੇ ਦੋਸਤਾਂ ਨੂੰ ਵੀ ਬਹੁਤ ਵਧੀਆ ਲੱਗਿਆ ਅਤੇ ਉਹ ਉਹ ਵੀ ਇਹ ਓਡਰ ਕਰਨਾ ਚਾਹੁੰਦੇ ਹਨ ਅਤੇ ਇੱਕ ਤਾਂ ਇਹ ਮੈਨੂੰ ਬਹੁਤ ਹੀ ਸਸਤੇ ਰੇਟ 'ਤੇ ਮਿਲ ਗਿਆ ਉਹ ਵੀ ਇਹ ਓਡਰ ਕਰਨਾ ਚਾਹੁੰਦੇ ਹਨ